ਸਤਿ ਸ਼੍ਰੀ ਅਕਾਲ ਮੈਮ ਮੈਮ ਐਡਵੋਕੇਟ ਸਮਰੀਤੀ ਦੇ ਨਾਲ਼ ਗੱਲ ਹੋ ਰਹੀ ਆ ਮੈਮ ਮੈਂ ਨਾ ਰੋਪੜ ਸਾਈਡ ਤੋਂ ਗੱਲ ਕਰ ਰਹੀ ਹਾਂ ਮੈਮ ਮੈਂ ਨਾ ਤੁਹਾਡੇ ਨਾਲ਼ ਆਪਣਾ ਕੇਸ ਡਿਸਕਸ ਕਰਨਾ ਸੀ ਮੈਨੂੰ ਆਪਣੇ ਕਿਸੇ ਫੈਮਿਲੀ ਫ੍ਰੈਂਡ ਤੋਂ ਤੁਹਾਡਾ ਪਤਾ ਲੱਗਿਆ ਮੈਮ ਸਾਡਾ ਕੁਛ ਮੈਟਰੀਮੋਨੀਅਲ ਡਿਸਪਿਊਟ ਆ ਕਿ ਮੈਨੂੰ ਆਪਣੇ ਹਸਬੈਂਡ ਤੋਂ ਡੀਵੋਰਸ ਚਾਹੀਦਾ ਆ ਮੈਮ ਰੀਜ਼ਨ ਇਹ ਹੈ ਕਿ ਆਪਾਂ ਇਕੱਠੇ ਨਹੀਂ ਰਹਿ ਰਹੇ ਹਾਂ ਬਹੁਤ ਸਾਰੇ ਟਾਈਮ ਤੋਂ ਅਤੇ ਮੈਮ ਜਿਹੜਾ ਸਾ ਮੇਰਾ ਹਸਬੈਂਡ ਹੈ ਉਹ ਸਾਡੇ 'ਤੇ ਜਾਂ ਮੇਰੇ 'ਤੇ ਜਾਂ ਸਾਡੀ ਫੈਮਿਲੀ 'ਤੇ ਨਾ ਇੰਨਾਂ ਧਿਆਨ ਨਹੀਂ ਦਿੰਦਾ ਬਹੁਤ ਹੀ ਜ਼ਿਆਦਾ ਮਤਲਬ ਸਾਡੇ ਦਿਲ ਵਿੱਚ ਨਾ ਡਿਫ਼ਰੈਸਿਜ਼ ਨੇ ਮੈਮ ਮੈ ਮੈਨੂੰ ਹੋ ਚੁੱਕਿਆ ਏ ਇੱਕ ਸਾਲ ਅਲੱਗ ਰਹਿੰਦੇ ਨੂੰ ਮੈਂ ਆਪਣੇ ਬੇਬੀ ਦੇ ਨਾਲ਼ ਰਹਿੰਦੀ ਹਾਂ ਮੈਂ ਇੱਕ ਵਰਕਿੰਗ ਵੁਮੈਨ ਹਾਂ ਅਤੇ ਮੈਨੂੰ ਜਿਹੜਾ ਇਹ ਕੰਮ ਵੀ ਸੰਭਾਲਣਾ ਪੈਂਦਾ ਆਪਣੇ ਬੱਚੇ ਨੂੰ ਵੀ ਸੰਭਾਲਣਾ ਪੈਂਦਾ ਜਿਹੜਾ ਮੇਰਾ ਹਸਬੈਂਡ ਹੈ ਕੋਈ ਵੀ ਰਿਸਪੋਨਸੀਬੀਲਟੀ ਹੈ ਨਹੀਂ ਲੈਂਦਾ ਹਾਂਜੀ ਮੈਮ ਹਲੇ ਤੱਕ ਮੈਂ ਨਹੀਂ ਕੀਤਾ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਤੁਹਾਡੇ ਦੁਆਰਾ ਜਿਹੜਾ ਇਹ ਡੀਵੋਰਸ ਹੈ ਇਹ ਫਾਈਲ ਕਰਾਂ ਠੀਕ ਹੈ ਮੈਮ ਮੈਮ ਆਪਣਾ ਫ਼ੀਸ ਸਟੱਕਚਰ ਵਗੈਰਾ ਕਿ ਕਿੱਦਾਂ ਕੁ ਰਹੇਗਾ ਠੀਕ ਹੈ ਮੈਮ ਤੁਸੀਂ ਮੈਨੂੰ ਆਪਣੇ ਔਫ਼ਿਸ ਦੀ ਡੀਟੇਲਸ ਦੇ ਸਕਦੇ ਹੋ ਕਿ ਕਿੱਥੇ ਹੈ ਠੀਕ ਹੈ ਮੈਮ ਅਤੇ ਉਹ ਦੱਸ ਦਿਓ ਕਿ ਕੁੱਛ ਮਤਲਬ ਕੀ ਤੁਹਾਡਾ ਕੁਛ ਹੋਰ ਐਡੀਸ਼ਨਲ ਚਾਰਜਿਸ ਕਿ ਜਿੱਦਾਂ ਆਪਣੀ ਤੁਹਾਡੀ ਫ਼ੀਸ ਤੋਂ ਇਲਾਵਾ ਕੋਰਟ ਦੀ ਕੁਛ ਜਿੱਦਾਂ ਫ਼ੀਸ ਵਗੈਰਾ ਉਹ ਅਲੱਗ ਤੋਂ ਉਹ ਦੇ ਲਈ ਕੁਛ ਠੀਕ ਹੈ ਮੈਮ ਅਤੇ ਮੈਂ ਆਪਣੇ ਨਾਲ਼ ਕੁਛ ਪੇਪਰ ਵਗੈਰਾ ਲੈ ਕੇ ਵੀ ਆਉਣੇ ਨੇ ਠੀਕ ਹੈ ਮੈਮ ਓਕੇ ਮੈਮ ਥੈਂਕ ਯੂ